ਮੈਂ ਆਪਣੀ ਰਸੋਈ ਵਿੱਚ ਬਹੁਤ ਤਰ੍ਹਾਂ ਦੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾਉਣੀਆਂ ਬ ਆਪਣੀ ਬੇਟੀ ਨੂੰ ਵੀ ਸਿਖਾ ਰਹੀ ਹਾਂ ਔਰ ਕੁਛ ਉਹਨਾਂ ਤੋਂ ਸਿੱਖ ਵੀ ਰਹੀ ਹਾਂ ਜਿਵੇਂ ਨਵੀਆਂ ਚੀਜ਼ਾਂ ਏ ਜਿਵੇਂ ਸਾਨੂੰ ਨਹੀਂ ਆਉਂਦੀਆਂ ਉਹ ਜਿਵੇਂ ਬੱਚੇ ਅੱਜ ਕੱਲ੍ਹ ਬ੍ਰੈੱਡ ਦੀ ਬਹੁਤ ਸਾਰੀ ਰੈਸਿਪੀਜ਼ ਬਣਾਉਂਦੀ ਆ ਪੀਜ਼ਾ ਬਣਾਉਂਦੇ ਆ ਔਰ ਪਾਸਤਾ ਬਣਾਉਂਦੇ ਆ ਇਹ ਮੈਂ ਆਪਣੀ ਬੇਟੀ ਤੋਂ ਸਿੱਖ ਰਹੀ ਹਾਂ ਔਰ ਜਿਹੜੇ ਸਾਡੇ ਪਹਿਲਾਂ ਤੋਂ ਚੱਲੇ ਆ ਰਹੀਆਂ ਜਿਵੇਂ ਸਬਜ਼ੀਆਂ ਹੋਗੀਆਂ ਦਾਲ਼ਾਂ ਹੋਗੀਆਂ ਉਹ ਮੈਂ ਆਪਣੀ ਬੇਟੀ ਔਰ ਆਪਣੀ ਬੇਟੇ ਨੂੰ ਵੀ ਸਿਖਾਉਂਦੀ ਹਾਂ ਇਹ ਜ਼ਰੂਰੀ ਨਹੀਂ ਹੈਗਾ ਕਿ ਬੇਟੀਆਂ ਹੀ ਸਿੱਖਣ ਮੈਂ ਚਾਹੁੰਦੀ ਮੇਰੇ ਬੱਚਾ ਮੇਰਾ ਮੁੰਡਾ ਵੀ ਸਿੱਖੇ ਉਹਨੂੰ ਕੁਕਿੰਗ ਦਾ ਵੈਸੇ ਸ਼ੌਂਕ ਵੀ ਹੈਗਾ ਪਰ ਕੱਲ੍ਹ ਨੂੰ ਅੱਗੇ ਜਾ ਕੇ ਜੇ ਉਹਨੂੰ ਇਕੱਲੇ ਨੂੰ ਕਿਤੇ ਰਹਿਣਾ ਪੈ ਗਿਆ ਉਹ ਬੇਸਿਕ ਜਿਹੀ ਕਰ ਸਕੇ ਕੁਕਿੰਗ ਵੀ ਆਪਣੇ ਆਪ ਵਾਸਤੇ ਜਿਵੇਂ ਰੋਟੀ ਸਬਜ਼ੀ ਸਿੰਪਲ ਬਣਾ ਸਕੇ ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾ ਰਹੀ ਹਾਂ ਔਰ ਬੱਚਿਆਂ ਤੋਂ ਕੁਛ ਸਿੱਖ ਵੀ ਰਹੀ ਹਾਂ